ਜਿਵੇਂ ਕਿ ਬਹੁਤ ਤਰ੍ਹਾਂ ਦੇ ਡਾਂਸ ਹੁੰਦੇ ਹਨ ਜਿੱਦਾਂ ਕਿ ਸਾਡੇ ਪੰਜਾਬ ਦੇ ਵਿੱਚ ਜਿਹੜੇ ਸਭ ਤੋਂ ਜ਼ਿਆਦਾ ਫੇਮੱਸ ਹਨ ਭੰਗੜਾ ਗਿੱਧਾ ਝੂੰਮਰ ਲੁੱਡੀ ਅਤੇ ਗੁਜਰਾਤੀ ਡਾਂਸ ਡਾਂਡੀਆਂ ਗੜਬਾ ਅਤੇ ਹੋਰ ਵੀ ਬਹੁਤ ਸਾਰੇ ਜਿਵੇਂ ਕਿ ਕਲਾਸੀਕਲ ਡਾਂਸ ਕੱਥਕ ਡਾਂਸ ਅਤੇ ਹੀਪ ਹੋਪ ਫ੍ਰੀ ਡਾਂਸ ਕੋਕਰੋਚ ਸਟਾਈਲ ਬਹੁਤ ਹੀ ਵੱਖ ਵੱਖ ਤਰ੍ਹਾਂ ਦੇ ਡਾਂਸ ਹਨ